ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਨਾ ਤੁਹਾਡੇ ਕੈਬ ਬੁੱਕ ਕੀਤੀ ਸੀ ਮੈਂ ਉੱਥੇ ਹਿਮਾਚਲ ਘੁੰਮਣ ਵਾਸਤੇ ਉਹ ਐਕਚੁਲੀ ਨਾ ਮੇਰਾ ਕੈਬ ਤੁਹਾਨੂੰ ਪਤਾ ਹਿਮਾਚਲ ਦੇ ਵਿੱਚ ਥੋੜ੍ਹਾ ਜਿਹਾ ਪ੍ਰੋ ਇਸ ਟਾਇਮ ਮੌਸਮ ਵੀ ਠੀਕ ਨਹੀਂ ਚੱਲ ਰਿਹਾ ਹੈਗਾ ਇਸ ਕਰਕੇ ਨਾ ਮੈਂ ਕੈਬ ਨੂੰ ਨਾ ਉਹਨੂੰ ਕੈਂਸਲ ਕਰਨਾ ਚਾਹੁੰਦਾ ਹਾਂ ਅਤੇ ਮੈਂ ਤੁਹਾਨੂੰ ਐਡਵਾਂਸ ਪੇ ਕੀਤਾ ਸੀ ਤਿੰਨ ਹਜ਼ਾਰ ਰੁਪਇਆ ਅਤੇ ਉਹ ਤਿੰਨ ਹਜ਼ਾਰ ਰੁਪਇਆ ਤੁਸੀਂ ਮੈਨੂੰ ਪਲੀਜ਼ ਜਾਂ ਤਾਂ ਗੂਗਲ ਪੇ ਜਾਂ ਮੈਨੂੰ ਕੈਸ਼ ਕਿਸੇ ਵੀ ਪ੍ਰਕਾਰ ਤੁਸੀਂ ਮੈਨੂੰ ਦੇ ਸਕਦੇ ਓਂ ਰਿਕੁਵੈਸਟ ਹੈ ਸਰ ਅਤੇ ਬਾਕੀ ਮੌਸਮ ਦੀ ਹਾਲਾਤ ਮਾੜੇ ਹੋਣ ਕਰ ਕੇ ਮੈਂ ਨਹੀਂ ਜਾ ਸਕਿਆ ਇਸ ਚੀਜ਼ ਲਈ ਮੈਂ ਸੋਰੀ ਫੀਲ ਕਰਦਾ ਹਾਂ ਜੀ ਅਤੇ ਬਾਕੀ ਦੀ ਜਿਹੜੇ ਮੇਰਾ ਜੋ ਵੀ ਤੁਹਾਡੇ ਕੋਲ ਕੈਸ਼ ਹੈ ਤਿੰਨ ਹਜ਼ਾਰ ਰੁਪਇਆ ਉਹ ਤੁਸੀਂ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਕੋਂਟੈਕਟ ਕਰਿਓ ਵਧ ਵਾਪਸ ਮੈਨੂੰ ਦੱਸਿਓ ਕਿ ਮੈਂ ਤੋਹ ਤੁਸੀਂ ਕੈਸ਼ ਕਰਨਾ ਕੈਸ਼ ਕਰ ਦਿਓ ਤੁਸੀਂ ਮੈਨੂੰ ਗੂਗਲ ਪੇ ਕਰਨਾ ਗੂਗਲ ਪੇ ਕਰ ਦਿਓ ਜਿੱਦਾਂ ਤੁਹਾਨੂੰ ਠੀਕ ਲੱਗੇ ਸਰ ਠੀਕ ਹੈ ਸਰ ਜੀ